ਮੈਨੂੰ ਸਟਾਰ ਗੈਜਿੰਗ ਦਾ ਇੰਨਾਂ ਸਟਾਰ ਗੈਜਿੰਗ 'ਚ ਇੰਨਾਂ ਇੰਟਰਸਟ ਨਹੀਂ ਹੈ ਪਰ ਫਿਰ ਵੀ ਮੈਨੂੰ ਆਕਾਸ਼ ਨੂੰ ਦੇਖਣ ਦਾ ਬਹੁਤ ਹੀ ਵਧੀਆ ਲੱਗਦਾ ਕਿਉਂਕਿ ਜਦ ਚਾਰੇ ਚਮਕਦੇ ਹਨ ਤਾਂ ਬਹੁਤ ਹੀ ਅੱਛੇ ਲੱਗਦੇ ਹਨ ਆਕਾਸ਼ ਨੂੰ ਵੇਖਣ ਦਾ ਸਹੀ ਸਮਾਂ ਤਾਂ ਰਾਤ ਹੀ ਹੈ ਜੇ ਕਿਉਂਕਿ ਦਿਨ ਵਿੱਚ ਜ਼ਿਆਦਾ ਸਰਦੀਆਂ ਕਰਕੇ ਜ਼ਿਆਦਾ ਧੁੰਦ ਕਾਰਨ ਆਕਾਸ਼ ਇੰਨਾਂ ਸਾਫ਼ ਨਹੀਂ ਦਿਨਦਾ ਰਾਤ ਨੂੰ ਬਹੁਤ ਹੀ ਵਧੀਆ ਦਿਖਦਾ ਹੈ ਜੇਕਰ ਮੈਂ ਤਾਰਿਆਂ ਦੀ ਗੱਲ ਕਰੀ ਜਾਵੇ ਤਾਂ ਜਿਹੜਾ ਧਰੂਵ ਤਾਰਾ ਹੁੰਦਾ ਬਹੁਤ ਹੀ ਵਧੀਆ ਚਮਕਦਾ ਹੈ ਸਭ ਤੋਂ ਜ਼ਿਆਦਾ ਤਾਰਾ ਉਹੀ ਚਮਕਦਾ ਹੈ ਤਾਰੇ ਨੂੰ ਵੇਖਣ ਲਈ ਬਹੁਤ ਹੀ ਮੈਨੂੰ ਬਹੁਤ ਹੀ ਵਧੀਆ ਲੱਗਦਾ ਹੈ ਮੈਂ ਰਾਤ ਨੂੰ ਆਪਣੇ ਕੋਠੇ 'ਤੇ ਜਾ ਕੇ ਅਕਸਰ ਤਾਰਿਆਂ ਨੂੰ ਦੇਖਦੀ ਹਾਂ ਤਾਂ ਕਰਕੇ ਮੈਨੂੰ ਤਾਰੇ ਬਹੁਤ ਹੀ ਵਧੀਆ ਲੱਗਦੇ ਨੇਗੇ ਦੇਖਣੇ ਕਿਉਂਕਿ ਉਹ ਚਮਕਦੇ ਹੀ ਇੰਨੇ ਅੱਛੇ ਨੇ ਗੇ